ਬੱਚਿਆਂ ਨੂੰ ਸਕੂਲ ਦੇ ਵਿੱਚ ਨਾ ਹਰ ਹਰ ਤਰ੍ਹਾਂ ਦੀ ਨਾ ਐਕਟੀਵਿਟੀ ਹੋਣੀ ਚਾਹੀਦੀ ਹੈ ਜਿਵੇਂ ਕਿ ਉਹਨਾਂ ਨੂੰ ਜਿੱਦਾਂ ਹਰ ਰਿਟਰਨਾ ਹੋ ਗਿਆ ਟੈਕਸੀਸ ਹੋ ਗਏ ਕਰਜ਼ਿਆਂ ਨੂੰ ਕਿਵੇਂ ਉਤਾਰੀ ਦਾ ਜਾਂ ਕਿੱਦਾਂ ਲਈ ਦਾ ਕਿਸ ਤਰੀਕੇ ਨਾਲ ਕਰਜ਼ੇ ਚੜ੍ਹਾਈ ਦੇ ਆ ਜਾਂ ਉਹ ਚੀਜ਼ਾਂ ਦੇ ਬਾਰੇ ਨਾ ਸਾਰਾ ਕੁਛ ਸਕੂਲ ਦੇ ਸਿਲੇਬਸ ਦੇ ਵਿਚ ਹੋਣਾ ਚਾਹੀਦਾ ਤਾਂ ਕਿ ਬੱਚਿਆਂ ਨੂੰ ਅੱਗੇ ਬਿਜ਼ਨੇਸ ਦੇ ਬਾਰੇ ਪਤਾ ਲੱਗੇ ਅਤੇ ਉਹ ਰੁਟੀਨ ਵਾਈਜ਼ ਇਹਨਾਂ ਚੀਜ਼ਾਂ ਨੂੰ ਲਰਨ ਕਰਦੇ ਰਹਿਣ